ਮੈਂ ਆਪਣੇ ਇੱਕ ਨਵੇਂ ਘਰ ਵਿੱਚ ਚਲੀ ਗਈ ਹਾਂ ਅਤੇ ਪਿਛਲੇ ਮਾਲਕਾਂ ਦੁਆਰਾ ਜੋ ਵੀ ਘਰ ਫਰਨੀਚਰ ਛੱਡਿਆ ਗਿਆ ਉਸਨੂੰ ਸਾਫ ਕਰਨ ਲਈ ਅਤੇ ਮੈਂ ਨਵਾਂ ਸਮਾਂ ਨਿਰਧਾਰਤ ਕਰਨਾ ਚਾਹੁੰਦੀ ਹਾਂ ਇਸ ਲਈ ਮੈਂ ਇੱਕ ਥੋੜ੍ਹਾ ਕੂੜਾ ਚੁੱਕਣ ਵਾਲੀ ਰਹਿੰਦ ਖੁੰਹਦ ਪ੍ਰਬੰਧਨ ਕਮੇਟੀ ਨੂੰ ਮਤਲਬ ਕਾਲ ਕੀਤਾ ਹੈ ਉਹਨਾਂ ਨੂੰ ਕਾਲ ਕਰਕੇ ਮੈਂ ਉਹਨਾਂ ਨੂੰ ਨਾ ਇੱਕ ਨਿਪਟਾਰਾ ਕਰਨ ਦੇ ਬਾਰੇ ਵਿੱਚ ਦੱਸਿਆ ਕਿ ਕੀ ਕੀ ਸਮਾਨ ਚੱਕਿਆ ਜਾਵੇ ਅਤੇ ਇਸ ਦੇ ਅਕੋਰਡਿੰਗ ਮੈਂ ਉਹਨਾਂ ਨੂੰ ਇਸ ਦੇ ਨਾਲ ਹੀ ਉਹਨਾਂ ਨੂੰ ਸਮਾਂ ਵਗੈਰਾ ਮਿਤੀ ਵਗੈਰਾ ਦੱਸੀ ਹੈ ਕਿ ਤੁਸੀਂ ਉਸ ਦਿਨ ਆ ਕੇ ਸਾਰਾ ਜੋ ਰਹਿੰਦ ਖੁੰਹਦ ਜੋ ਵੀ ਰਹਿ ਗਿਆ ਉਹਨੂੰ ਸਾਫ ਕਰ ਦਿਓ